ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਪਾਲਜੀਤ ਸਿੰਘ ਆ ਅਤੇ ਸਾਡੇ ਪੰਜਾਬ ਵਿੱਚ ਕਈ ਪ੍ਰਮੁੱਖ ਟੈਕਨੋਲਜੀ ਉਤਪਾਦ ਆ ਚੁੱਕੇ ਹਨ ਜੋ ਕਿ ਕਈ ਤਰ੍ਹਾਂ ਦੀ ਵੱਡੀਆਂ ਵੱਡੀਆਂ ਕੰਪਨੀਆਂ ਸਾਨੂੰ ਪ੍ਰਦਾਨ ਕਰਦੀਆਂ ਹਨ ਪੰਜਾਬ ਵਿੱਚ ਵੀ ਇਹ ਐਸੀਆਂ ਕਈ ਕੰਪਨੀਆਂ ਆ ਚੁੱਕੀਆਂ ਹਨ ਜੋ ਸਾਨੂੰ ਕਈ ਤਰ੍ਹਾਂ ਦੇ ਸਾਫਟਵੇਅਰ ਹਾਰਡਵੇਅਰ ਡਿਵਾਈਸਾਂ ਪ੍ਰਦਾਨ ਕਰਦੇ ਹਨ ਜੋ ਕਿ ਜਿਵੇਂ ਕਿ ਲੈਪਟੋਪ ਵਿੱਚ ਹੁੰਦਾ ਜਿੱਦਾਂ ਕਿ ਏ ਸੀ ਵਗੈਰਾ ਜਿੱਦਾਂ ਕਿ ਮਾਈਕਰੋਵੇਵ ਹੁੰਦਾ ਹੈ ਇਹ ਸਭ ਸਾਨੂੰ ਵੱਡੀਆਂ ਵੱਡੀਆਂ ਕੰਪਨੀਆਂ ਬਣਾ ਕੇ ਦੇ ਦਿੰਦੀਆਂ ਹਨ ਅਤੇ ਅਸੀਂ ਇਹਨਾਂ ਦਾ ਇਸਤੇਮਾਲ ਕਰਦੇ ਹਾਂ ਅਤੇ ਪੰਜਾਬ ਵਿੱਚ ਹੋਰ ਕਈ ਕਈ ਵੱਡੇ ਕੰਪਨੀਆਂ ਜਿਵੇਂ ਕਿ ਰਿਲਾਇੰਸ ਜਿਵੇਂ ਕਿ ਐਚ ਡੀ ਡੀ ਐੱਫ ਨੇ ਕਈ ਕੰਪਨੀਆਂ ਆ ਚੁੱਕੀਆਂ ਹਨ ਜੋ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਅਸੀਂ ਦੇਖਦੇ ਹਾਂ ਅਤੇ ਇਹਨਾਂ 'ਤੇ ਕਈ ਤਕਨੋਲਜੀ ਉਤਪਾਦ ਬਣ ਚੁੱਕੇ ਹਨ ਅਤੇ ਇਹ ਕਈ ਸੇਵਾ ਪ੍ਰਦਾਨ ਕਰਦੇ ਸਨ ਸਾਨੂੰ ਜਿਵੇਂ ਕਿ ਡਿਜੀਟਲ ਮਾਰਕੀਟਿੰਗ ਆਪਾਂ ਕੋਈ ਵੀ ਘਰ ਤੋਂ ਸਮਾਨ ਖਰੀਦ ਸਕਦੇ ਇਨ੍ਹਾਂ ਉਤਪਾਦਾਂ ਦਾ ਉਪਯੋਗ ਕਰਕੇ ਜੋ ਕਿ ਵੱਡੀਆਂ ਵੱਡੀਆਂ ਕੰਪਨੀਆਂ ਨੇ ਸ਼ੁਰੂ ਕੀਤੇ ਹਨ ਜੋ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਸਾਡੀ ਬਹੁਤ ਮਦਦ ਕਰਦੇ ਹਨ ਵਿਚਰਨ ਵਿੱਚ ਲੋਕਾਂ ਵਿੱਚ ਵਿਚਰਨ ਵਿੱਚ ਅਤੇ ਸਾਨੂੰ ਸਭ ਨੂੰ ਇਹ ਲਾਜ਼ਮੀ ਹੈ ਕਿ ਪਤਾ ਹੋਣਾ ਚਾਹੀਦਾ ਹੈ ਇਹਨਾਂ ਸਭ ਬਾਰੇ ਜੋ ਕਿ ਬਹੁਤ ਜ਼ਰੂਰੀ ਹਨ ਅਤੇ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਹੈ ਧੰਨਵਾਦ